ਮੇਰਾ ਨਾਮ ਵਿਸ਼ਾਲ ਕੁਮਾਰ ਹੈ ਮੇਰੇ ਘਰ ਨਾ ਰਿਸ਼ਤੇਦਾਰ ਆਏ ਹੋਏ ਸਨ ਅਤੇ ਮੇਰੇ ਘਰ ਦੇ ਸ ਜਲਦੀ ਖਾਣਾ ਪਕਵਾਨ ਨਹੀਂ ਕਰ ਸਕਦੇ ਸਨ ਅਤੇ ਇਸ ਕਰਕੇ ਮੈਂ ਪ੍ਰੀਤ ਪੈਲਸ ਢਾਬੇ ਤੋਂ ਇੱਕ ਔਡਰ ਬੁੱਕ ਕੀਤਾ ਅਤੇ ਉਹਨਾਂ ਨੇ ਜਿਵੇਂ ਮੈ ਮੰਗਵਾਇਆ ਸੀ ਦਾਲ਼ ਮੱਖਣੀ ਦਾਲ਼ ਦਾਲ਼ ਮੱਖਣੀ ਪਨੀਰ ਟਿੱਕਾ ਪਨੀਰ ਚਿੱਲੀ ਪਨੀਰ ਦੀ ਸਬਜ਼ੀ ਚਾਵਲ ਫੁਲਕੇ ਤੰਦੂਰੀ ਰੋਟੀ ਮੰਗਵਾਏ ਸਨ ਅਤੇ ਪਨ ਪ੍ਰੀਤ ਪੈਲਸ ਵਾਲ਼ਿਆਂ ਨੇ ਬਹੁਤ ਢਾਬੇ ਵਾਲ਼ਿਆਂ ਦੇ ਮੈਨੇਜਰ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਮੇਰਾ ਔਡਰ ਸਮੇਂ 'ਤੇ ਪਹੁੰਚਾ ਦਿੱਤਾ ਅਤੇ ਬਹੁਤ ਹੀ ਸ਼ੁੱਧ ਖਾਣਾ ਸੀ ਅਤੇ ਮੇਰੇ ਘਰਦਿਆਂ ਨੇ ਵੀ ਬਹੁਤ ਉਹਨਾਂ ਦਾ ਔਡਰ ਲੈ ਕੇ ਆਏ ਅਤੇ ਉਹਨਾਂ ਦਾ ਡਿਲੀਵਰੀ ਬੋਆਏ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਡਿਲੀਵਰੀ ਬਰਾਏ ਬੋਆਏ ਦੀ ਬੋਲਬਾਣੀ ਬਹੁਤ ਹੀ ਵਧੀਆ ਸੀ ਅਤੇ ਸਤਿਕਾਰਯੋਗ ਸੀ ਅਤੇ ਇਹ ਸ਼ੁੱਧ ਖਾਣਾ ਮੇਰੇ ਰਿਸ਼ਤੇਦਾਰਾਂ ਨੇ ਖਾ ਕੇ ਉਹਨਾਂ ਦਾ ਬਹੁਤ ਤਾਰੀਫ਼ ਕੀਤੀ ਤਾਰੀਫ਼ ਕਰਦੇ ਸਮੇਂ ਉਹਨਾਂ ਨੇ ਕਿਹਾ ਕਿ ਬਹੁਤ ਹੀ ਵਧੀਆ ਸਵਾਦਿਸ ਅਤੇ ਟੇਸਟ ਖਾਣਾ ਲੱਗਿਆ ਅਤੇ ਮੈਂ ਪ੍ਰੀਤ ਪੈਲਸ ਮੈਨੇਜਰ ਦਿਲ ਦਾ ਧੰਨਵਾਦ ਕਰਦਾ ਹਾਂ ਕਿ ਅੱਗੇ ਤੋਂ ਵੀ ਮੈਂ ਤੁਹਾਡਾ ਖਾਣਾ ਔਡਰ ਕਰਵਾਇਆ ਕਰੂੰਗਾ ਅਤੇ ਬਹੁਤ ਹੀ ਸਵਾਦਿਸ ਅਤੇ ਵਧੀਆ ਲੱਗਿਆ ਮੈਨੂੰ ਅਤੇ ਮੇਰੇ ਰਿਸ਼ਤੇਦਾਰਾਂ ਨੇ ਤੇ ਵੀ ਤੁਹਾਡੀ ਤਾਰੀਫ਼ ਕੀਤੀ ਅਤੇ ਉਹਨਾਂ ਨੂੰ ਵੀ ਬਹੁਤ ਸਵਾਦ ਹੀ ਲੱਗਿਆ ਤੁਹਾਡਾ ਖਾਣਾ ਧੰਨਵਾਦ ਜੀ ਪ੍ਰੀਤ ਪੈਲਸ ਵਾਲ਼ਿਆਂ ਦਾ